ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਫਲਿੱਪਕਾਰਟ ਕਸਟਮਰ ਕੇਅਰ ਵਾਲਿਆਂ ਤੋਂ ਬੋਲ ਰਹੇ ਹੋ ਮੈਂ ਪਿਛਲੇ ਦਿਨੀਂ ਨਾ ਤੁਹਾਡੇ ਤੋਂ ਹੀ ਇੱਕ ਸੇਲ ਤੋਂ ਇੱਕ ਕੁੜਤੀ ਬਾਏ ਕੀਤੀ ਸੀਗੀ ਜਿਸ ਦਾ ਪ੍ਰਾਈਜ ਬਹੁਤ ਘੱਟ ਸੀਗਾ ਤਾਂ ਉਹ ਦੇਖ ਕੇ ਇੱਦਾਂ ਲੱਗ ਰਿਹਾ ਸੀ ਉਹਦਾ ਪ੍ਰਾਈਜ਼ ਜ਼ਿਆਦਾ ਹੈ ਤਾਂ ਜਦੋਂ ਮੈਂ ਬਾਏ ਕੀਤੀ ਮੈਂ ਔਡਰ ਰਸੀਵ ਕੀਤਾ ਤਾਂ ਜਦੋਂ ਮੈਂ ਉਹਨੂੰ ਵੀਅਰ ਕਰਕੇ ਦੇਖਿਆ ਤਾਂ ਬਹੁਤ ਉਹ ਚੰਗੀ ਲੱਗ ਰਹੀ ਸੀਗੀ ਤਾਂ ਜਿਵੇਂ ਉਸ ਦੀ ਫਿਟਿੰਗ ਨਾ ਮੇਰੇ ਲਈ ਹੀ ਬਣੀ ਹੋਏ ਬਹੁਤ ਅੱਛੀ ਆਈ ਹੈ ਅਤੇ ਉਸ ਦਾ ਕਲਰ ਵੀ ਬਹੁਤ ਅੱਛਾ ਸੀ ਅਤੇ ਸਟਫ ਬਹੁਤ ਜ਼ਿਆਦਾ ਸੋਫਟ ਸੀ ਅਤੇ ਹਲਕਾ ਸੀ ਤਾਂ ਉਹ ਗਰਮੀਆਂ 'ਚ ਵੀਅਰ ਵਾਲਾ ਹੀ ਲੱਗ ਰਿਹਾ ਸੀ ਮਤਲਬ ਇਕਦਮ ਇੱਦਾਂ ਲੱਗ ਰਿਹਾ ਸੀ ਵੀ ਗਰਮੀ ਲੱਗ ਹੀ ਨਹੀਂ ਰਹੀ ਤਾਂ ਬਹੁਤ ਜ਼ਿਆਦਾ ਅੱਛਾ ਸਟੱਫ਼ ਸੀ ਜਦੋਂ ਮੈਂ ਉਹ ਵੀਅਰ ਕੀਤਾ ਤਾਂ ਸਾਰਿਆਂ ਨੂੰ ਇੱਦਾਂ ਲੱਗ ਰਿਹਾ ਸੀ ਇਦੀ ਪੁੱਛ ਰਹੇ ਸੀ ਵੀ ਕਿੱਥੋਂ ਮੰਗਵਾਈ ਆ ਸ਼ਾਇਦ ਜ਼ਿਆਦਾ ਮਹਿੰਗੀ ਹੋਵੇਗੀ ਬਟ ਮੈਂ ਉਹਨਾਂ ਨੂੰ ਦੱਸਿਆ ਵੀ ਪ੍ਰਾਈਜ਼ ਵੀ ਰੀਜ਼ਨਏਬਲ ਹੈ ਅਤੇ ਮੈਂ ਇੱਥੋਂ ਬਾਏ ਕੀਤੀ ਹੈ ਤਾਂ ਉਹ ਲੋਕ ਕਹਿ ਉਹ ਸਾਰੇ ਇਹ ਹੀ ਕਹਿ ਰਹੇ ਸੀ ਵੀ ਤੁਸੀਂ ਸਾਡੇ ਲਈ ਵੀ ਹੀ ਬਾਏ ਕਰਕੇ ਦਿਓ ਉਹਨਾਂ ਨੂੰ ਤਾਂ ਇਹ ਮੈਂ ਉਹ ਤੁਹਾਡੇ ਨਾਲ ਇੱਕ ਅੱਛਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਸੀ ਆਪਣੇ ਵਾਲਾ ਧੰਨਵਾਦ